ਹਾਂਜੀ ਜੇਕਰ ਖੇਤੀਬਾੜੀ ਉਦਯੋਗ ਵਿੱਚ ਸੁਧਾਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਮਸ਼ੀਨੀ ਬਹੁਤ ਸਾਰੀਆਂ ਮਸ਼ੀਨੀ ਪ੍ਰਕਿਰਿਆਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕੀ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਮਸ਼ੀਨਾਂ ਇਸ ਇਸਤਮਾਲ ਹੁੰਦੀਆਂ ਹਨ ਉਹਨਾਂ ਵਿੱਚ ਨਵੀਂ ਟੈਕਨੋਲਜੀ ਦਾ ਆਉਣਾ ਬਹੁਤ ਜ਼ਰੂਰੀ ਹੈ ਅਤੇ ਕਿਸਾਨਾਂ ਵਿੱਚ ਵੀ ਅਵੇਅਰਨੈੱਸ ਦਾ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ